ਪਸ਼ੂਆਂ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਪਸ਼ੂਆਂ ਦਾ ਬਹੁਤ ਇਸਤੇਮਾਲ ਹੁੰਦਾ ਹੈ ਜਿਵੇਂ ਖੇਤੀ ਕਰਨ ਦੇ ਲਈ ਦੁੱ ਦੁੱਧ ਲੈਣ ਦੇ ਲਈ ਅਤੇ ਆਪਣਾ ਉਹਨਾਂ ਦੇ ਗੋਬਰਾਂ ਗੋਬਰ ਦਾ ਵੀ ਕਾਫ਼ੀ ਇਸਤੇਮਾਲ ਹੁੰਦਾ ਜਿਵੇਂ ਪਾਥੀਆਂ ਪੱਥਣ ਲਈ ਅੱਗ ਬਾਲਣ ਲਈ ਜਾਂ ਗੋਬਰ ਪਲਾਂਟ ਲਗਾਉਣ ਲਈ ਅਤੇ ਇਸ ਕਰਕੇ ਇੱਥੇ ਪਸ਼ੂਆਂ ਦੀ ਕਾਫ਼ੀ ਦੇਖਭਾਲ ਕੀਤੀ ਜਾਂਦੀ ਹੈ ਜਿਵੇਂ ਸਾਡੇ ਗਾਂ ਮੱਝਾਂ ਸਾਡੇ ਪਸ਼ੂ ਨੇ ਪਾਲਤੂ ਪਸ਼ੂ ਨੇ ਇਹ ਸਾਡੇ ਪੰਜਾਬ ਦੇ ਘਰਾਂ ਦੇ ਵਿੱਚ ਆਮ ਹੁੰਦੇ ਹਨ ਅਤੇ ਇਹਨਾਂ ਦਾ ਸਵੇਰ ਤੋਂ ਹੀ ਕੰਮ ਸ਼ੁਰੂ ਹੋ ਜਾਂਦਾ ਜਿਵੇਂ ਲੋਕ ਕੀ ਕਰਦੇ ਹਨ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੱਝਾਂ ਗਾਂ ਦੇ ਪੱਠੇ ਲੈਣ ਜਾਂਦੇ ਹਨ ਪੱਠੇ ਵੱਢ ਕੇ ਇਹ ਲਿਆਉਂਦੇ ਹਨ ਅਤੇ ਜਦੋਂ ਆਉਂਦੇ ਹਨ ਤਾਂ ਗਾਂ ਨੂੰ ਆਉਂਦੇ ਸਾਰ ਹੀ ਪੱਠੇ ਪਾ ਦਿੰਦੇ ਹਨ ਪੱਠੇ ਦੇ ਵਿੱਚ ਪੱਠੇ ਫੀਡ ਦਾਣੇ ਕਣਕ ਆਦਿ ਵਗੈਰਾ ਗਾਂ ਦੇ ਭੋਜਨ ਲਈ ਪਾ ਦਿੰਦੇ ਹਨ ਅਤੇ ਉਸ ਤੋਂ ਬਾਅਦ ਗਾਂ ਨੂੰ ਨਲਾਉਂਦੇ ਹਨ ਨਲਾਉਣ ਤੋਂ ਬਾਅਦ ਉਹਨਾਂ ਦਾ ਅ ਮਤਲਬ ਕਿ ਜਿੱਥੇ ਉਹ ਆਪਣਾ ਰਹਿੰਦੇ ਹਨ ਜਿਹੜੀ ਜਗ੍ਹਾ 'ਤੇ ਗਾਂ ਰੱਖੀਆਂ ਹੁੰਦੀਆਂ ਨੇ ਉਹ ਜਗ੍ਹਾ ਦੀ ਸਫ਼ਾਈ ਕਰਦੇ ਹਨ ਅਤੇ ਉਸ ਤੋਂ ਬਾਅਦ ਧਾਰਾਂ ਚੌਂਦੇ ਹਨ ਅਤੇ ਉਹਨਾਂ ਦਾ ਗੋਬਰ ਵਗੈਰਾ ਇਕੱਠਾ ਕਰਕੇ ਉਹਨਾਂ ਦੀਆਂ ਪਾਥੀਆਂ ਪਾਥੀਆਂ ਬਣਾ ਕੇ ਰੱਖਦੇ ਹਨ ਅਤੇ ਉਸ ਤੋਂ ਬਾਅਦ ਦੁਪਹਿਰ ਨੂੰ ਫਿਰ ਇਹਨਾਂ ਨੂੰ ਪੱਠੇ ਪਾਏ ਜਾਂਦੇ ਹਨ ਸ਼ਾਮ ਨੂੰ ਔਰਤਾਂ ਜਾਂ ਮਰਦ ਜਾ ਕੇ ਦੁਬਾਰਾ ਪੱਠੇ ਕੱਖ ਘਾਹ ਵਗੈਰਾ ਆਪਣਾ ਕੱਟ ਕੇ ਲਿਆਉਂਦੇ ਹਨ ਅਤੇ ਸ਼ਾਮ ਨੂੰ ਆ ਕੇ ਫਿਰ ਮੱਝਾਂ ਗਾਂ ਨੂੰ ਪਾ ਕੇ ਉਸ ਤੋਂ ਬਾਅਦ ਇਹਨਾਂ ਦੀ ਧਾਰਾਂ ਚੌਂਦੇ ਹਨ ਅਤੇ ਧਾਰਾਂ ਚੌਣ ਤੋਂ ਬਾਅਦ ਇਹਨਾਂ ਦਾ ਮਲ ਇਹਨਾਂ ਦੀ ਸਾਫ਼ ਸਫ਼ਾਈ ਕਰਨ ਤੋਂ ਬਾਅਦ ਇਹਨਾਂ ਦਾ ਪਹਿਲਾ ਹੀ ਰਾਤ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਹਨਾਂ ਕੋਲ ਕੱਖ ਵਗੈਰਾ ਰੱਖ ਦਿੰਦੇ ਹਨ ਅਤੇ ਇਹ ਦਿਨ ਭਰ ਇਹ ਹੀ ਕੰਮ ਕਰਦੇ ਰਹਿੰਦੇ ਹਨ